ਦੌੜਦੇ ਸਮੇਂ ਤਾਂ ਮੈਂ ਇੱਕੋ ਹੀ ਬੰਦਾ ਸੁਣਦਾ ਤਾਂ ਇੱਕੋ ਹੀ ਬੰਦਾ ਆਪਾਂ ਨੂੰ ਵਧੀਆ ਲੱਗਦਾ ਉਹ ਹੈ ਸਿੱਧੂ ਮੂਸੇਆਲਾ ਅਤੇ ਉਹਦੇ ਗਾਣੇ ਸਾਨੂੰ ਸੁਣ ਕੇ ਹੈ ਨਾ ਹਿੰਮਤ ਆਉਂਦੀ ਹੈ ਤਾਂ ਉਸਦੇ ਗਾਣਿਆਂ 'ਚ ਅਣਖ ਹੈ ਅਤੇ ਕੁਛ ਗਲਤ ਨਹੀਂ ਗਾਉਂਦਾ ਮਤਲਬ ਕਿ ਨਸ਼ਿਆਂ ਵਗੈਰਾ 'ਤੇ ਨਹੀਂ ਗਾਣੇ ਜਾਂ ਕੁੜੀਆਂ 'ਤੇ ਨਹੀਂ ਗਾਣੇ ਉਹ ਬੰਦੇ ਦੀ ਆਮ ਜ਼ਿੰਦਗੀ ਦੇ ਗਾਣੇ ਨੇ ਜੋ ਕਿ ਬੰਦੇ ਨੂੰ ਕੁਝ ਸਿਖਾਉਂਦੇ ਨੇ ਕਿ ਹਾਂ ਤੂੰ ਕੁਝ ਕਰਨਾ ਤੂੰ ਅੱਗੇ ਵਧਣਾ ਹੈ ਕਿ ਇਹ ਚੀਜ਼ਾਂ ਤੋਂ ਦੂਰ ਰਹਿ ਆਪਣੇ ਆਪ 'ਤੇ ਫੋਕਸ ਕਰ ਮੇਨ ਇਹ ਆ ਕਿ ਉਹਦੇ ਗਾਣਿਆਂ ਨਾਲ ਸਾਨੂੰ ਜ਼ੋਰ ਮਿਲਦਾ ਹੈ ਤਾਂ ਮੈਂ ਸ਼ੁਰੂ ਤੋਂ ਹੀ ਉਹਦੇ ਗਾਣੇ ਸੁਣਦਾ ਜਦ ਦਾ ਉਸ ਉਹਨੇ ਇੰਡਸਟਰੀ 'ਚ ਆਇਆ ਉਹ ਤਾਂ ਮੈਂ ਉਹਦੇ ਹੀ ਗਾਣੇ ਸੁਣਦਾ ਰਿਹਾ ਤਾਂ ਹੁਣ ਵੀ ਸੁਣਦਾ ਹੈ ਤਾਂ ਉਹਦੇ ਗਾਣਿਆਂ ਨਾਲ ਮੇਰਾ ਮਾਇੰਡ ਸੈਡ ਤੋਂ ਵਧੀਆ ਵਧੀਆ ਮਨ ਹੋ ਜਾਂਦਾ ਹੈ ਕਿ ਖੁਸ਼ ਹੋ ਜਾਂਦਾ ਹੈ ਕਿ ਹਾਂ ਅਗਰ ਜ਼ਿੰਦਗੀ 'ਚ ਕੁਝ ਕਰਨਾ ਹੈ ਤੂੰ ਅੱਗੇ ਵਧਣਾ ਹੈ ਤੂੰ ਹਾਰਨਾ ਨਹੀਂ ਅਤੇ ਇਹੀ ਹੈ ਬਸ